ਜੀ ਹਾਂ ਮੇਰੇ ਤੋਂ ਇੱਕ ਗਾਂ ਅਤੇ ਇੱਕ ਕੁੱਤਾ ਹੈ ਅਤੇ ਸਾਨੂੰ ਗਾਂ ਹਰ ਰੋਜ਼ ਬਾਰਾਂ ਕਿਲੋ ਦੁੱਧ ਦਿੰਦੀ ਹੈ ਸਵੇਰ ਨੂੰ ਵੀ ਛੇ ਕਿਲੋ ਅਤੇ ਸ਼ਾਮ ਨੂੰ ਵੀ ਅਤੇ ਅਸੀਂ ਉਸਦੀ ਦੇਖਭਾਲ ਬਹੁਤ ਹੀ ਚੰਗੀ ਤਰ੍ਹਾਂ ਕਰਦੇ ਹਾਂ ਅਸੀਂ ਉਸਦੀ ਦੇਖਭਾਲ ਘਾਹ ਲਿਆ ਕੇ ਕਰਦੇ ਹਾਂ ਉਹਨੂੰ ਸਵੇਰੇ ਵੀ ਘਾਹ ਲਿਆਉਣਾ ਹੁੰਦਾ ਹੈ ਅਤੇ ਸ਼ਾਮ ਨੂੰ ਵੀ ਘਾਹ ਲਿਆਉਣਾ ਹੁੰਦਾ ਹੈ ਅਤੇ ਹੋਰ ਵੀ ਉਸਨੂੰ ਫੀਡ ਵਗੈਰਾ ਸਾਰੀਆਂ ਚੀਜ਼ਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਅਤੇ ਮੇਰੇ ਤੋਂ ਜਿਹੜਾ ਕੁੱਤਾ ਹੈ ਉਸਦੀ ਦੇਖਭਾਲ ਵੀ ਮੈਂ ਬਹੁਤ ਅੱਛੇ ਤਰੀਕੇ ਨਾਲ ਕਰਦਾ ਹਾਂ ਉਸਨੂੰ ਰੋਜ਼ ਨਹਿਲਾਉਂਦਾ ਹਾਂ ਔਰ ਰੋਜ਼ ਦੀ ਫੀਡ ਰਿਹਾ ਆਉਂਦਾ ਹਾਂ ਉਸਦੀ ਫੀਡ ਬਹੁਤ ਮਹਿੰਗੀ ਆਉਂਦੀ ਹੈ ਜਿਹੜੀ ਫੀਡ ਛੇ ਸੱਤ ਹਜ਼ਾਰ ਰੁਪਏ ਦੀ ਆਉਂਦੀ ਹੈ ਅਤੇ ਫੀਡ ਪੈਡੀ ਗਿਰੀ ਹੁੰਦੀ ਹੈ ਅਤੇ ਹੋਰ ਵੀ ਕਈ ਫੀਡ ਮਹਿੰਗੀਆਂ ਮਹਿੰਗੀਆਂ ਹੁੰਦੀ ਹੈ ਅਤੇ ਮੈਂ ਪਸ਼ੂਆਂ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਹੋਰ ਵੀ ਬਿੱਲੀ ਵੀ ਹੈ